ਇੱਕ ਬਹੁਤ ਹੀ ਦਿਲਚਸਪ ਘਟਨਾ ਜਿਹੜੀ ਕਿ ਮੇਰੀ ਅਸੀਂ ਇਸ ਵਾਰ ਤੀਜਾਂ ਮਨਾਈਆਂ ਬਹੁਤ ਹੀ ਵਧੀਆ ਰਿਹਾ ਅਤੇ ਉਸ ਤੀਜਾਂ ਦੇ ਵਿੱਚ ਐੱਮ ਐੱਲ ਏ ਸਾਹਿਬ ਕੁਲਵੰਤ ਸਿੰਘ ਜੀ ਦੀ ਜਿਹੜੀ ਨੂੰਹ ਹੈ ਉਹ ਮੁੱਖ ਮਹਿਮਾਨ ਵਜੋਂ ਆਏ ਅਤੇ ਸਾਨੂੰ ਬਹੁਤ ਵਧੀਆ ਲੱਗਿਆ ਇੰਟਰਨੈਸ਼ਨਲ ਟੀਮ ਵੀ ਗਿੱਧੇ ਦੀ ਆਈ ਹੋਈ ਸੀ ਜਿਸ ਨਾਲ ਅਸੀਂ ਪੂਰਾ ਐਨ ਇੰਜੋਆਏਮੈਂਟ ਕੀਤਾ ਸਾਡੇ ਕੁਲੀਗ ਸਾਰੇ ਨਾਲ ਸੀਗੇ ਅਤੇ ਕੁੜੀਆਂ ਨੇ ਬਹੁਤ ਵਧੀਆ ਗਿੱਧਾ ਪਾਇਆ ਅਤੇ ਉਥੇ ਖਾਣ ਪੀਣ ਦਾ ਅਰੇਂਜਮੈਂਟ ਵੀ ਕੀਤਾ ਹੋਇਆ ਸੀ ਉਹਨਾਂ ਨੇ ਵਧੀਆ ਐਨ ਅਤੇ ਸਾਰੇ ਜਿਹੜੇ ਆਪਣੇ ਏਰੀਏ ਦੇ ਲੋਕ ਸੀ ਬਹੁਤ ਖੁਸ਼ੀ ਸੀ ਆਪਣੇ ਤੀਜਾਂ ਦੇ ਤਿਉਹਾਰ ਨੂੰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਿਸ ਨਾਲ ਵੀ ਲੋਕਾਂ 'ਚ ਇਸ ਤਿਉਹਾਰ ਨੂੰ ਹਰ ਸਾਲ ਮਨਾਉਣ ਲਈ ਬਹੁਤ ਲੋਕ ਉਤਸ਼ਾਹਿਤ ਹੋਏ